ਸਤਿ ਸ਼੍ਰੀ ਅਕਾਲ ਜੀ ਮੈਂ ਬਲਜਿੰਦਰ ਕੌਰ ਮੈਂ ਨੁਰਪੂਰ ਬੇਦੀ ਦੀ ਰਹਿਣ ਵਾਲੀ ਹਾਂ ਮੈਂ ਮੈਂ ਤੁਹਾਡੀ ਕੰਪਨੀ ਤੋਂ ਇੱਕ ਟੈਕਸੀ ਬੁੱਕ ਕੀਤੀ ਸੀ ਨੂਰਪੁਰ ਬੇਦੀ ਤੋਂ ਅਨੰਦਪੁਰ ਸਾਹਿਬ ਜਾਣ ਲਈ ਮੈਂ ਹੁਣ ਇਹ ਪਲੈਨ ਕੈਂਸਲ ਕਰ ਦਿੱਤਾ ਹੈ ਕਿਰਪਾ ਕਰਕੇ ਮੇਰੇ ਪੈਸੇ ਰਿਫੰਡ ਕੀਤੇ ਰਿਫੰਡ ਕੀਤੇ ਜਾਣ ਕਿਉਂਕਿ ਮੈਂ ਔਨਲਾਈਨ ਪੇਮੈਂਟ ਪਹਿਲਾਂ ਹੀ ਕਰ ਦਿੱਤੀ ਸੀ ਕਿਰਪਾ ਕਰਕੇ ਮੇਰੇ ਪੈਸੇ ਰਿਫੰਡ ਕੀਤੇ ਜਾਣ ਧੰਨਵਾਦ